ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਪ੍ਰੀਤ ਕੌਰ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਗੀਤਾਂ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੀ ਹਾਂ ਅਤੇ ਮੈਨੂੰ ਗੀਤ ਵਗੈਰਾ ਬਹੁਤ ਪਸੰਦ ਆ ਮੈਂ ਆਪਣੇ ਘਰ ਫਰੀ ਟਾਈਮ ਬੈਠ ਕੇ ਵੀ ਗੀਤ ਵਗੈਰਾ ਸੁਣਦੀ ਹਾਂ ਅਤੇ ਮੇਰੇ ਪਰਿਵਾਰ ਪਰਿਵਾਰ ਵਾਲਿਆਂ ਨੂੰ ਵੀ ਗੀਤ ਬਹੁਤ ਪਸੰਦ ਹਨ ਉਹ ਵੀ ਮੇਰੇ ਨਾਲ ਬੈਠ ਕੇ ਗੀਤ ਸੁਣਦੇ ਹਨ ਅਤੇ ਜਿਵੇਂ ਕਿ ਸਾਡੇ ਪੰਜਾਬ ਵਿੱਚ ਸੱਭਿਆਚਾਰਿਕ ਗੀਤ ਵੀ ਆ ਅਤੇ ਸੱਭਿਆਚਾਰਕ ਗੀਤਾਂ ਵਿੱਚੋਂ ਮੈਨੂੰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗੀਤ ਬਹੁਤ ਜ਼ਿਆਦਾ ਪਸੰਦ ਹੈ ਅਤੇ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗੀਤ ਬਹੁਤ ਜ਼ਿਆਦਾ ਵਧੀਆ ਹੁੰਦੇ ਹਨ ਅਤੇ ਉਸ ਘਰ ਵਿੱਚ ਸਾਰਿਆਂ ਦੇ ਸਾਹਮਣੇ ਬੈਠ ਕੇ ਸੁਣਨ ਵਾਲੇ ਹੁੰਦੇ ਹਨ ਅਤੇ ਅੱਜ ਕੱਲ੍ਹ ਦੇ ਗੀਤ ਜਿਹੜੇ ਹੁੰਦੇ ਹਨ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਉਹ ਗੀਤ ਆਪਣੇ ਘਰ ਵਿੱਚ ਬੈਠ ਕੇ ਸੁਣਨ ਵਾਲੇ ਨਹੀਂ ਹੁੰਦੇ ਅਤੇ ਜਿੱਦਾਂ ਸਰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਆ ਉਹ ਆਪਣੇ ਸੱਭਿਆਚਾਰਕ ਗੀਤ ਵਗੈਰਾ ਹੁੰਦੇ ਹਨ ਉਹਨਾਂ ਦੇ ਸੱਭਿਆਚਾਰਕ ਗੀਤ ਬੋਲਦੇ ਹਨ ਅਤੇ ਸੱਭਿਆਚਾਰਕ ਗੀਤ ਬੋਲਦੇ ਤਾਂ ਕਾਲਾ ਡੋਰੀਆ ਅਤੇ ਅਤੇ ਹੋਰ ਪ੍ਰਕਾਰ ਦੇ ਗੀਤ ਅਤੇ ਉਹਨਾਂ ਨੂੰ ਪੰਜਾਬ ਦੀ ਕੋਇਲਾ ਦਾ ਵੀ ਦਰਜਾ ਮਿਲਿਆ ਹੋਇਆ ਹੈ ਅਤੇ ਉਹਨਾਂ ਦਾ ਕਿਤਾਬਾਂ ਵਿੱਚ ਵੀ ਨਾਮ ਆਉਂਦਾ ਅਤੇ ਕਿਤਾਬਾਂ ਵਿੱਚ ਉਹਨਾਂ ਦੇ ਲੈਸਨ ਵਗੈਰਾ ਬਣੇ ਹੋਏ ਹਨ ਅਤੇ ਉਹਨਾਂ ਦਾ ਸਾਰਾ ਉਹਨਾਂ ਵਿੱਚ ਵੀ ਥੋੜ੍ਹੇ ਲੈਸਨਾਂ ਵਿੱਚ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਗਾਣਿਆਂ ਬਾਰੇ ਦੱਸਿਆ ਗਿਆ ਹੈ ਅਤੇ ਇਹਨਾਂ ਦੇ ਗਾਣੇ 'ਤੇ ਅੱਜ ਕੱਲ੍ਹ ਦੇ ਗੀਤ ਅਤੇ ਵੈਸੇ ਘਰ ਬੈਠ ਕੇ ਸੁਣਨ ਵਾਲੇ ਹੁੰਦੇ ਨਹੀਂ ਹੈ ਅਤੇ ਮੈਂ ਇਹਨਾਂ ਗੀਤਾਂ ਜਿੱਦਾਂ ਪ੍ਰਕਾਸ਼ ਕੌਰ ਦੇ ਗੀਤਾਂ 'ਤੇ ਆਪਣੇ ਸਕੂਲ ਵਿੱਚ ਪਰਫੋਰਮੈਂਸ ਵੀ ਕੀਤੀ ਉਹਨਾਂ 'ਤੇ ਡਾਂਸ ਵਗੈਰਾ ਸਿੱਖਿਆ ਹੈ ਅਤੇ ਮੈਂ ਆਪਣੇ ਮਤਲਬ ਕਿਤੇ ਅਕੈਡਮੀ ਹੈ ਡਾਂਸ ਦੀ ਮੈਂ ਉੱਥੇ ਵੀ ਡਾਂਸ ਸਿੱਖਿਆ ਅਤੇ ਮੈਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਅਤੇ ਮੈਂ ਉਹਨਾਂ ਉੱਤੇ ਵੀ ਡਾਂਸ ਸਿੱਖਿਆ ਹੋਇਆ